ਹਾਂਜੀ ਮੈਂ ਆਪਦੇ ਦੋਸਤਾਂ ਨਾਲ ਸਫਰ ਕੀਤਾ ਹੋਇਆ ਹੈ ਬਾਈਕ 'ਤੇ ਅਸੀਂ ਨੈਣਾ ਦੇਵੀ ਘੁੰਮਣ ਗਏ ਸੀ ਅਸੀਂ ਇੱਕ ਬਾਈਕ 'ਤੇ ਦੋ ਦੋ ਜਣੇ ਗਏ ਹੋਏ ਸੀ ਅਤੇ ਅਸੀਂ ਜਿੰਨਾ ਵੀ ਸਾਰਾ ਸਮਾਨ ਸੀ ਸਾਰਾ ਬਾਈਕ 'ਤੇ ਹੀ ਲੱਦ ਕੇ ਲੈ ਕੇ ਗਏ ਸੀ ਜਿਵੇਂ ਕਿ ਸਾਡਾ ਖਾਣ ਪੀਣ ਦੀਆਂ ਚੀਜ਼ਾਂ ਕੱਪੜੇ ਹੋਰ ਸਾਰਾ ਸਮਾਨ ਅਤੇ ਅਸੀਂ ਜਿਵੇਂ ਹਵਾ ਭਰਨ ਵਾਲਾ ਪੰਪ ਉਹ ਸਾਰਾ ਕੁਛ ਵੀ ਨਾਲ ਲੈ ਕੇ ਗਏ ਸੀ ਕਿਉਂਕਿ ਅੱਜ ਕੱਲ੍ਹ ਟਿਊਬਲੈਸ ਟਾਇਰ ਹੁੰਦੇ ਆ ਮਤਲਬ ਉਹ ਹਵਾ ਨਾਲ ਵੀ ਚੱਲ ਜਾਂਦੇ ਆ ਅਤੇ ਸਾਨੂੰ ਬਹੁਤ ਹੀ ਆਨੰਦ ਆਇਆ ਉਸ ਯਾਤਰਾ ਵਿੱਚ ਅਤੇ